ਜਿਵੇਂ ਕਿ ਮੈਨੂੰ ਬੁਣਾਈ ਅਤੇ ਕਢਾਈ ਦਾ ਬਹੁਤ ਸ਼ੌਂਕ ਹੈਗਾ ਆ ਮੈਂ ਕਈ ਨਵੇਂ ਜੰਮੇ ਬੱਚੇ ਕਿਸੇ ਹੋਰ ਦਾ ਕੀ ਮੈਂ ਆਪਣੇ ਬੱਚਿਆਂ ਲਈ ਬੂਟ ਆਹਾ ਪੋਤੜੇ ਅਤੇ ਹੋਰ ਲਨ ਕੀ ਉਹਦਾ ਨਾਮ ਕੱਪੜੇ ਛੋਟੇ ਛੋਟੇ ਬਣਾ ਕੇ ਫਰੋਕਾਂ ਜਿਹੀਆਂ ਪਹਿਲਾਂ ਤਾਂ ਇਹ ਹੀ ਬੱਚਿਆਂ ਨੂੰ ਪਵਾਏ ਜਾਂਦੇ ਸੀ ਅੱਜ ਕੱਲ੍ਹ ਤਾਂ ਚਲੋ ਰੈਡੀਮੇਟ ਮਿਲਗੇ ਪਰ ਕਈ ਹਾਲੇ ਵੀ ਪੋਤੜੇ ਬਣਾ ਕੇ ਵਿਛਾਉਣੀਆਂ ਆਪ ਬਣਾ ਕੇ ਕੋਟਨ ਦੀਆਂ ਬੱਚਿਆਂ ਨੂੰ ਉਹ ਹੀ ਪਵਾਉਂਦੇ ਹੈਗੇ ਆ ਅਤੇ ਮੈਂ ਸਾਡੇ ਰਿਸ਼ਤੇਦਾਰਾਂ ਦੇ ਵੀ ਕਿੰਨੇ ਬੱਚੇ ਹੋਏ ਆ ਕਿੰਨਿਆਂ ਨੂੰ ਪੋਤੜੇ ਬਣਾ ਬਣਾ ਕੇ ਮੈਂ ਦਿੱਤੇ ਸੀਗੇ ਗਿਫਟ ਦੀ ਤੌਰ 'ਤੇ ਬਹੁਤ ਮਤਲਬ ਪਹਿਲਾਂ ਤਾਂ ਬਹੁਤ ਜ਼ਿਆਦਾ ਅੱਛਾ ਲੱਗਦਾ ਹੁੰਦਾ ਸੀ ਕੋਟਨ ਦੇ ਕੱਪੜਿਆਂ ਨਾਲ ਹੁਣ ਚਲੋ ਬਹੁਤ ਜ਼ਿਆਦਾ ਜਮਾਨਾ ਬਦਲ ਗਿਆ ਆ ਪਰ ਫਿਰ ਵੀ ਅੱਜ ਕੱਲ੍ਹ ਕਈ ਘਰ ਦੇ ਆਪ ਸੁਲਾ ਕੇ ਅਤੇ ਬੁਣ ਕੇ ਮੋਜੇ ਬਣਾ ਕੇ ਟੋਪੀਆਂ ਬਣਾ ਕੇ ਇੱਦਾਂ ਦੇ ਬੱਚਿਆੰ ਨੂੰ ਪਵਾਉਂਦੇ ਹੈਗੇ ਕਈ ਤਾਂ ਪੁਰਾਣੇ ਹੀ ਬਣੇ ਹੋਏ ਪਾਉਂਦੇ ਹੈਗੇ ਆ ਕਈ ਜੇ ਨਵੇਂ ਜਿੱਦਣ ਪਾਉਂਦੇ ਆ ਤੇ ਆਪ ਹਾ ਹੱਥ ਦੇ ਬਣੇ ਹੋਏ ਪਾਉਂਦੇ ਆ